ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ ਜਿਸ ਕਰਕੇ ਮੈਂ ਅਤੇ ਮੇਰੇ ਦੋਸਤ ਨੇ ਪਲੈਨ ਬਣਾਇਆ ਕਿਤੇ ਘੁੰਮਣ ਦਾ ਅਤੇ ਅਸੀਂ ਘੁੰਮਣ ਗਏ ਕਸੋਲ ਦੀ ਪਹਾੜ ਅਤੇ ਤੇ ਅਸੀਂ ਉੱਥੇ ਜਾ ਕੇ ਪਹਾੜ ਚੜਨ ਲੱਗੇ ਫਿਰ ਉੱਥੇ ਅਸੀਂ ਜਦ ਅਸੀਂ ਪਹਾੜ ਅੱਧਾ ਚੜ ਗਏ ਸੀਗੇ ਫਿਰ ਇੱਕ ਅਚਾਨਕ ਹੀ ਮੇਰੇ ਦੋਸਤ ਦਾ ਪੈਰ ਸਲਿਪ ਹੋ ਗਿਆ ਜਿਸ ਕਰਕੇ ਉਹ ਪਹਾੜ ਤੋਂ ਤਿਲਕਦਾ ਹੋਇਆ ਨੀਚੇ ਨੂੰ ਜਾਣ ਲੱਗਿਆ ਅਤੇ ਉੱਥੇ ਦਾ ਹੀ ਇੱਕ ਰਹਿਣ ਵਾਲੇ ਨੇ ਉਸਨੂੰ ਰੋਕਿਆ ਅਤੇ ਉਹਦੀ ਜਾਨ ਬਚਾਈ ਮੈਂ ਉਸ ਦਾ ਸਾਹਸ ਦੇਖ ਕੇ ਬਹੁਤ ਖੁਸ਼ ਹੋਇਆ ਕਿ ਉਸਨੇ ਮੇਰੇ ਜੋ ਦੋਸਤ ਦੀ ਜਾਨ ਬਚਾ ਲਈ

ਉਹਨੂੰ ਉਸ ਤੋਂ ਸਾਨੂੰ ਸੀਖ ਮਿਲਦਾ ਹੈ ਕਿ ਸਾਨੂੰ ਕਦੇ ਵੀ ਪਹਾੜ 'ਤੇ ਚੜ੍ਹਦੇ ਸਮੇਂ ਘਟੀਆ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਮੇਰੇ ਦੋਸਤ ਨੇ ਘਟੀਆ ਕੰਪਨੀ ਦੇ ਬੂਟ ਪਾਏ ਹੋਏ ਸੀ ਜਿਸ ਕਰਕੇ ਉਹਦੇ ਪੈਰ ਸਲਿਪ ਹੋ ਗਏ ਅਤੇ ਉਹ ਪਹਾੜ ਤੋਂ ਤਿਲਕਦਾ ਹੋਇਆ ਨੀਚੇ ਨੂੰ ਆ ਗਿਆ ਜੇ ਜਦੋਂ ਵੀ ਅਸੀਂ ਪਹਾੜ 'ਤੇ ਚੜ੍ਹਨਾ ਹੁੰਦਾ ਫਿਰ ਸਾਨੂੰ ਆਪਣੇ ਸੇਫਟੀ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਆਪਣੇ ਸੇਫਟੀ ਦੇ ਨਾਲ ਦੀ ਸਾਰੀ ਚੀਜ਼ਾਂ ਲੈ ਕੇ ਤੁਰਨੀ ਚਾਹੀਦੀ ਹੈ ਜਿਵੇਂ ਰੱਸਾ ਆਦਿ ਹੋਰ ਵੀ ਕਈ ਚੀਜ਼ਾਂ ਸਾਨੂੰ ਬੂਟ ਵਧੀਆ ਕੰਪਨੀ ਦੇ ਪਾਉਣੇ ਚਾਹੀਦੇ ਹੈ ਜਿਸ ਕਰਕੇ ਸਾਡਾ ਪੈਰ ਵੀ ਸਲਿਪ ਨਾ ਹੋਵੇ ਪਹਾੜ ਚੜ੍ਹਦੇ ਸਮੇਂ ਅਤੇ ਰੱਸੀ ਦਾ ਵਰਤੋਂ ਕਰਕੇ ਸਾਨੂੰ ਪਹਾੜ 'ਤੇ ਚੜ੍ਹਨਾ ਚਾਹੀਦਾ ਹੈ ਜੇ ਤਾਂ ਕਿ ਜੇ ਸਾਡਾ ਪੈਰ ਵੀ ਸਲਿਪ ਹੋਵੇ ਤਾਂ ਅਸੀਂ ਰੱਸਾ ਨੂੰ ਫੜ ਕੇ ਰੁਕ ਜਾਈਏ